ਖੇਡ ਖੇਡਣ ਦੌਰਾਨ ਜਖਮੀ ਜਾਂ ਸਾਹਮਣਾ ਕਰਨ ਵਾਲੇ ਸਪੋਰਟਸ ਪਲੇਅਰਾਂ ਲਈ ਸਾਡੇ ਖੇਤਰ ਵਿੱਚ ਸਹੂਲਤਾਂ ਕੋਈ ਵੀ ਉਪਲਬਧ ਨਹੀਂ ਹਨ ਖਿਡਾਰੀਆਂ ਲਈ ਸਾਡੇ ਪੰਜਾਬ ਵਿੱਚ ਕੋਈ ਵੀ ਸਿਹਤ ਸਹੂਲਤ ਕੁਝ ਵੀ ਬਿਹਤਰੀ ਨਹੀਂ ਹੈ ਇਹ ਇਕ ਕੋੜਾ ਸੱਚ ਹੈ ਕਿ ਸਾਡੇ ਦੇਸ਼ ਲਈ ਆਪਣੀ ਜੀਵ ਜਾਨ ਨਾਲ ਮਿਹਨਤ ਕਰਨ ਵਾਲੇ ਖਿਡਾਰੀਆਂ ਮੈਡਲ ਲਿਆਉਣ ਵਾਲੇ ਖਿਡਾਰੀਆਂ ਦਾ ਕੋਈ ਵੀ ਫਿਊਚਰ ਨਹੀਂ ਹੈ ਇਹ ਸਾਡੀ ਸਰਕਾਰ ਦੀ ਨਾਕਾਮੀ ਹੈ ਮੈਡਲ ਲਿਆਉਣ ਵਾਲੇ ਖਿਡਾਰੀਆਂ ਨੂੰ ਨਾ ਹੀ ਕੋਈ ਨੌਕਰੀ ਮਿਲਦੀ ਆ ਬਾਅਦ ਵਿੱਚ ਅਤੇ ਵਿੱਤੀ ਸਹਾਇਤਾ ਜੋ ਵੀ ਮਿਲਦੀ ਆ ਉਹ ਵੀ ਬਹੁਤ ਘੱਟ ਮਿਲਦੀ ਹੈ ਜੋ ਕਿ ਇੰਟਰਨੈਸ਼ਨਲ ਖੇਡਣ ਵਾਲੇ ਖਿਡਾਰੀ ਵੀ ਬੇਰੁਜ਼ਗਾਰ ਬੈਠੇ ਅਤੇ ਹੁੰਦਾ ਕੀ ਆ ਸਿਰਫ ਅਗਰ ਮੈਡਲ ਜਿੱਤ ਕੇ ਲਿਆਉਂਦੇ ਆ ਤਾਂ ਇਹ ਸਿਰਫ ਫੇਸਬੁੱਕ ਯੂਟੀਊਬ 'ਤੇ ਇਹਨਾਂ ਦਾ ਇਹਨਾਂ ਦਾ ਪ੍ਰਦਰਸ਼ਨ ਕੀਤਾ ਜਾਂਦਾ ਬਸ ਉਥੋਂ ਤੱਕ ਹੀ ਸੀਮਤ ਰਹਿ ਜਾਂਦਾ ਹੈ